ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੱਛਾ ਅੱਛਾ ਜੀ ਅੱਛਾ ਤੁਸੀਂ ਪਲੱਸ ਟੂ ਕਾਹਦੇ ਵਿੱਚ ਕੀਤੀ ਹੋਈ ਹੈ ਕਿਹੜੇ ਸਬਜੈਕਟਾਂ ਨਾਲ ਪੜ੍ਹੀ ਹੋਈ ਆ ਅੱਛਾ ਅਤੇ ਤੁਸੀਂ ਅੱਗੇ ਬੀ ਏ ਅ ਸਿੰਪਲ ਕਰਨੀ ਹੈ ਕਿ ਓਨਰਸ ਦੇ ਵਿੱਚ ਕਰਨੀ ਹੈ ਨਹੀਂ ਜੇ ਤਾਂ ਤੁਸੀਂ ਬੀ ਏ ਸਿੰਪਲ ਕਰਨੀ ਆ ਫਿਰ ਤਾਂ ਤੁਸੀਂ ਜਿਹੜੇ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਤਾਂ ਨਹੀਂ ਹੋਏਗੀ ਇਹ ਇਹਦੇ ਲਈ ਤਾਂ ਫਿਰ ਜਿਹੜੇ ਪਟਿਆਲੇ ਵਿੱਚ ਹੋਰ ਕੋਲਜ ਨੇ ਜਿਵੇਂ ਮਹਿੰਦਰਾ ਕੋਲਜ ਮੋਦੀ ਜਾਂ ਖਾਲਸਾ ਕਾਲਜ ਵੀ ਵਧੀਆ ਵਾ ਉੱਥੇ ਤੁਸੀਂ ਫੈਕਲਟੀ ਨਾਲ ਗੱਲ ਕਰ ਸਕਦੇ ਹੋ ਤੁਹਾਨੂੰ ਉਹ ਦੱਸ ਦੇਣਗੇ ਐਡਮਿਸ਼ਨ ਬਾਰੇ ਉੱਥੇ ਅਤੇ ਯੂਨੀਵਰਸਿਟੀ ਦੇ ਵਿੱਚ ਤਾਂ ਜਿਹੜੀ ਨਵੀਂ ਇੱਕ ਸਕੀਮ ਆਈ ਆ ਫਾਈਵ ਯੀਅਰ ਇੰਟੀਗਰੇਟਡ ਕੋਰਸ ਨੇ ਉਹ ਉਸਦੇ ਵਿੱਚ ਤੁਸੀਂ ਓਨਰਸ ਦੇ ਵਿੱਚ ਵੀ ਕਰ ਸਕਦੇ ਹਾਂ ਜਿਵੇਂ ਤੁਸੀਂ ਹੁਣ ਹਿਸਟਰੀ ਪੜ੍ਹੀ ਹੋਈ ਆ ਤੁਸੀਂ ਬੀ ਏ ਹਿਸਟਰੀ ਓਨਰਸ ਦੇ ਵਿੱਚ ਕਰ ਸਕਦੇ ਹਾਂ ਉਹਦੇ ਵਿੱਚ ਪੰਜ ਸਾਲਾਂ ਦੇ ਕੋਰਸ ਹੁੰਦੇ ਨੇ ਤੁਸੀਂ ਕਿਸੇ ਵੀ ਸਬਜੈਕਟ ਵਿੱਚ ਕਰ ਸਕਦੇ ਹਾਂ ਰਿਲੀਜ਼ਨ ਵਿੱਚ ਵੀ ਕਰ ਸਕਦੇ ਜੇ ਤੁਹਾਡਾ ਉਹਦੇ ਵਿੱਚ ਇੰਟਰਸਟ ਹੈਗਾ ਵਾ ਜੇ ਤਾਂ ਤੁਸੀਂ ਇੱਕ ਸਾਲ ਦੇ ਲਈ ਕਰੋਂਗੇ ਫਿਰ ਤਾਂ ਫਿਰ ਤਾਂ ਤੁਹਾਨੂੰ ਸਰਟੀਫਿਕੇਟ ਇੱਕ ਮਿਲੇਗਾ ਸਰਟੀਫਿਕੇਟ ਕੋਰਸ ਹੋ ਜਾਏਗਾ ਉਹ ਜੀ ਜੀ ਜੇ ਤੁਸੀਂ ਦੋ ਸਾਲ ਪੂਰੇ ਕਰੋਂਗੇ ਫਿਰ ਤੁਹਾਨੂੰ ਡਿਪਲੋਮਾ ਹੋ ਜਾਂਦਾ ਤੁਹਾਡਾ ਤੁਹਾਨੂੰ ਡਿਪਲੋਮੇ ਦਾ ਸਰਟੀਫਿਕੇਟ ਮਿਲੇਗਾ ਅਤੇ ਜੇ ਤੁਸੀਂ ਤਿੰਨ ਸਾਲ ਪੂਰੇ ਕਰ ਲਉਂਗੇ ਫਿਰ ਤੁਹਾਨੂੰ ਡਿਗਰੀ ਮਿਲ ਜਾਏਗੀ ਬੀ ਏ ਦੀ ਅਤੇ ਜੇ ਤੁਸੀਂ ਤਿੰਨ ਸਾਲ ਪੂਰੇ ਕਰਕੇ ਪੂਰੇ ਪੰਜ ਸਾਲ ਪੂਰੇ ਕੀਤੇ ਆ ਫਿਰ ਤੁਹਾਡੀ ਗ੍ਰੈਜੂਏਸ਼ਨ ਵੀ ਹੋ ਜਾਏਗੀ ਪੋਸਟ ਗ੍ਰੈਜੂਏਸ਼ਨ ਵੀ ਅਤੇ ਵਿੱਚ ਹੀ ਉਹਦੇ 'ਚ ਤੁਹਾਡਾ ਰਿਸਰਚ ਦਾ ਡੈਜੀਟੇਸ਼ਨ ਹੋ ਜੇਗਾ ਹਾਂ ਉਹ ਪੰਜ ਸਾਲਾਂ ਦੇ ਪੂਰੇ ਕੋਰਸ ਦੇ ਵਿੱਚ ਹੀ ਆ ਜੇਗਾ ਸਾਰਾ ਉਹਦੇ ਨਾਲ ਤੁਹਾਨੂੰ ਵੱਖਰੀ ਜਿਹੜੀ ਐੱਮ ਫਿਲ ਆਪਾਂ ਬੰਦ ਕਰਤੀ ਹੁਣ ਉਹ ਕਰਨ ਦੀ ਲੋੜ ਨਹੀਂ ਹੈਗੀ ਫਿਰ ਹੁਣ ਤੁਹਾਡੀ ਹਾਂ ਇਹਦੇ ਵਿੱਚ ਤੁਹਾਡੀ ਗ੍ਰੈਜੂਏਸ਼ਨ ਵੀ ਹੋ ਗਈ ਪੋਸਟ ਗ੍ਰੈਜੂਏਸ਼ਨ ਵੀ ਹੋ ਗਈ ਅਤੇ ਤੁਹਾਡਾ ਰਿਸਰਚ ਦੀ ਡੈਜੀਟੇਸ਼ਨ ਵੀ ਹੋ ਜਾਂਦੀ ਹੈ ਹਾਂ ਅਤੇ ਬਾਕੀ ਤੁਸੀਂ ਜੀ ਕਿਸੇ ਦਿਨ ਸਮਾਂ ਕੱਢ ਕੇ ਇੱਥੇ ਵਿਜ਼ਿਟ ਕਰ ਲਉ ਇੱਕ ਵਾਰ ਯੂਨੀਵਰਸਿਟੀ ਦੇ ਵਿੱਚ ਅਤੇ ਤੁਹਾਨੂੰ ਹਾਂਜੀ ਅਤੇ ਸ਼ਨੀ ਐਤਵਾਰ ਵੈਸੇ ਬੰਦ ਹੁੰਦੀ ਯੂਨੀਵਰਸਿਟੀ ਬਾਕੀ ਦੇ ਪੰਜ ਦਿਨ ਤੁਸੀਂ ਜਦੋਂ ਵੀ ਮਰਜ਼ੀ ਆ ਕੇ ਸਵੇਰੇ ਨੌ ਤੋਂ ਪੰਜ ਜਦੋਂ ਵੀ ਆਓ ਅਤੇ ਵਿਜ਼ਿਟ ਕਰਕੇ ਦੇਖ ਲਿਓ ਇੱਕ ਵਾਰ ਠੀਕ ਠੀਕ ਆ ਠੀਕ ਆ ਬੇਟਾ ਓ ਓਕੇ ਓਕੇ